ਪਿਛਲੇ ਹਫਤੇ ਦੀ ਗੱਲ ਹੈ ਮੈਂ ਨਾ ਬਾਜ਼ਾਰ 'ਚੋਂ ਉਹਦਾ ਕੰਪਨੀ ਦਾ ਫੇਸ ਮੋਸਕ ਲੈਣ ਗਿਆ ਸੀਗਾ ਮੈਨੂੰ ਉਹ ਐਵਰਗ੍ਰੀਨ ਕੰਪਨੀ ਦਾ ਫੇਸ ਮੋਕਸ ਮਿਲਿਆ ਨਹੀਂ ਤਾਂ ਦੁਕਾਨਦਾਰ ਨੇ ਕੋਈ ਹੋਰ ਕੰਪਨੀ ਦਾ ਮੈਨੂੰ ਫੇਸ ਮੋਕਸ ਦੇ ਤਾ ਵੀ ਹਾਂ ਇਹ ਵਧੀਆ ਹੈ ਬਹੁਤ ਹੀ ਸਾਰੇ ਫਾਇਦੇ ਆ ਲੋਕਾਂ ਨੇ ਯੂਜ਼ ਕਰਿਆ ਸਸਤਾ ਵੀ ਆ ਕਹਿੰਦੇ ਮੈਂ ਇਹਦੀ ਲੈ ਵੀ ਆਇਆ ਚਲੋ ਮੈਂ ਪਰ ਮੇਰਾ ਮਨ ਨਹੀਂ ਮੰਨਿਆ ਵੀ ਲੈ ਆ ਮੈਂ ਲੈ ਆਇਆ ਲੈ ਕੇ ਆ ਕੇ ਜਦੋਂ ਮੈਂ ਘਰੇ ਉਹਨੂੰ ਯੂਜ਼ ਕਰਿਆ ਤਾਂ ਪਹਿਲਾਂ ਤਾਂ ਮੇਰੇ ਚਿਹਰੇ 'ਤੇ ਖਾਜ ਜਿਹੀ ਹੋਣ ਲੱਗ ਗਈ ਖਾਜ ਹੁੰਦੀ ਹੁੰਦੀ ਚਲੋ ਮੈਂ ਫੇਰ ਉਤਾਰਤਾ ਮੈਂ ਮੈਨੂੰ ਲੱਗਦਾ ਵੀ ਮੈਂ ਦਸ ਕੁ ਸਕਿੰਟ ਵੀਹ ਕੁ ਸਕਿੰਟ ਹੱਦ ਰੱਖਿਆ ਸੀ ਉਹ ਆਪਣੇ ਚਿਹਰੇ 'ਤੇ ਜਦੋਂ ਖਾਜ ਹੋਣ ਲੱਗੀ ਮੈਂ ਉਤਾਰਤਾ ਇੱਕ ਤਾਂ ਉਤਰਿਆ ਵੀ ਬੜਾ ਔਖਾ ਉਹ ਚਿਹਰੇ ਪਰ ਤੋਂ ਜ ਮੈਂ ਉਤਾਰਿਆ ਤਾਂ ਮੇਰੇ ਮੇਰੇ ਸਾਰੇ ਚਿਹਰੇ 'ਤੇ ਫਿਨਸੀਆਂ ਜਿਹੀਆਂ ਹੋ ਗਈਆਂ ਖਾਜ ਹੋਣ ਲੱਗ ਗਈ ਮੇਰਾ ਚਿਹਰਾ ਸਾਰਾ ਲਾਲ ਹੋ ਗਿਆ ਉਹਨਾਂ ਨੇ ਮੈਨੂੰ ਮੇਰੇ ਚਿਹਰੇ ਨੂੰ ਹੋਰ ਖਰਾਬ ਕਰਤਿਆ ਬੜਾ ਬੜਾ ਪੰਗਾ ਹੋਇਆ ਉਸ ਦਿਨ ਤਾਂ ਮੈਂ ਉਸਦੀ ਇਹ ਸਲਾਹ ਦਿੰਦਾ ਵੀ ਉਹ ਕੰਪਨੀ ਨਾ ਕਰੋ ਐਵਰਗ੍ਰੀਨ ਹੈ ਐਵਰੀਕੋਰਸ ਕਰਾਸ ਸਾਰੇ ਵਧੀਆ ਹੈ ਇਹ ਜਿਹੇ ਯੂਜ਼ ਨਾ ਕਰੋ ਜਿਹੜੇ ਤੁਾਹਡੇ ਚਿਹਰੇ ਨੂੰ ਖਰਾਬ ਕਰ ਦੇਣ